ਹਾਂਜੀ ਗੱਲ ਕਰਦੇ ਹਾਂ ਹੁਣ ਮੱਛੀਆਂ ਦੀ ਮੱਛੀਆਂ ਜ਼ਿਆਦਾਤਰ ਆਪਾਂ ਕੀ ਕਰਦੇ ਹਾਂ ਸਰਦੀਆਂ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਹਨ ਇਸਦੇ ਵਿੱਚ ਤਿੰਨ ਤਰ੍ਹਾਂ ਦੀਆਂ ਜਦੋਂ ਕਿ ਮਸ਼ਹੂਰ ਇੱਥੇ ਆਪਣੇ ਪੰਜਾਬ ਦੇ ਵਿੱਚ ਮੰਨੀਆਂ ਜਾਂਦੀਆਂ ਹਨ ਇੱਕ ਹੁੰਦੀ ਹੈ ਸੰਘਾੜਾ ਇੱਕ ਹੁੰਦੀ ਹੈ ਮਲੀ ਇੱਕ ਹੁੰਦੀ ਹੈ ਸੂਈ ਇਹਨਾਂ ਤਿੰਨਾਂ ਮੱਛੀਆਂ ਜ਼ਿਆਦਾ ਪ੍ਰਚਲਿਤ ਇੱਥੇ ਪੰਜਾਬ ਦੇ ਵਿੱਚ ਇਹ ਹੀ ਹਨ ਹੁਣ ਅਗਰ ਜੇ ਮੇਰੀ ਮ ਮਨ ਪਸੰਦ ਦੀ ਗੱਲ ਕਰੀ ਜਾਵੇ ਮੱਛੀਆਂ ਦੀ ਤਾਂ ਮੇਰੀ ਮਨਪਸੰਦ ਮੱਛੀ ਹੈਗੀ ਹੈ ਸੂਈ ਜਿਹੜੀ ਕਿ ਸੂਈ ਮੱਛੀ ਹੁੰਦੀ ਹੈ ਬਹੁਤ ਜ਼ਿਆਦਾ ਨਰਮ ਅਰਪ ਔਰ ਜੀਭ ਦੇ ਉੱਪਰ ਰੱਖਦੀ ਸਾਰ ਘੁਲ ਜਾਂਦੀ ਹੈ ਔਰ ਜਿਹੜੀ ਸੰਘਾੜਾ ਮੱਛੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਚੀੜੀ ਹੁੰਦੀ ਹੈ ਪਰ ਵਰਤੋਂ ਦੀ ਇਹ ਵੀ ਇਹਦੀ ਵੀ ਇੱਥੀ ਜ਼ਿਆਦਾ ਉਨੀ ਹੁੰਦੀ ਹੈ ਪਰ ਇਹ ਚੀੜੀ ਹੁੰਦੀ ਹੈ ਖਾਣ ਦੇ ਵਿੱਚ ਜਿਵੇਂ ਕਿ ਮੁਰਗਾ ਹੈ ਮੁਰਗੇ ਦਾ ਮਾਸ ਹੋ ਗਿਆ ਇੱਦਾਂ ਦੇ ਹੀ ਫੀਲ ਹੁੰਦਾ ਹੈ ਸੰਘਾੜਾ ਮਲੀ ਅਤੇ ਸੂਈ ਇਹ ਬਹੁਤ ਜ਼ਿਆਦਾ ਨਰਮ ਮੱਛੀ ਹੁੰਦੀ ਹੈ ਇਹਦੇ ਨਾਲ ਇੱਕ ਦੇ ਵਿੱਚ ਕੰਡਾ ਵੀ ਜਿਹੜਾ ਹੁੰਦਾ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ ਜਾਂ ਜੋ ਕਿ ਛੇਤੀ ਦੇ ਕੇ ਕੱਢਿਆ ਜਾ ਸਕਦਾ ਹੈ ਜਿਹੜੀ ਇਹ ਹੁੰਦੀ ਹੈ ਆਪਣਾ ਸੰਘਾੜਾ ਦੀ ਮੱਛੀ ਦੀ ਉਹ ਉਹਦਾ ਕੰਡਾ ਬਹੁਤ ਜ਼ਿਆਦਾ ਹੈਵੀ ਹੁੰਦਾ ਹੈ ਕਈ ਵਾਰ ਗਲ ਦੇ ਵਿੱਚ ਲੱਗਣ ਨਾਲ ਗਲ ਦੇ ਵਿੱਚ ਜਖ਼ਮ ਵੀ ਹੋ ਜਾਂਦਾ ਹੈ ਇਸ ਕਰਕੇ ਮੈਂ ਤਾਂ ਆਪਣੇ ਹਿਸਾਬ ਨਾਲ ਇਹ ਹੀ ਲੋਕਾਂ ਨੂੰ ਸਲਾਹ ਦਿੰਦਾ ਹਾਂ ਵੀ ਜ਼ਿਆਦਾਤਰ ਮੱਛੀ ਜੇ ਤਾਂ ਖਾਣੀ ਹੈ ਤੁਸੀਂ ਤਾਂ ਥੋੜ੍ਹੀ ਕੀਮਤੀ ਜ਼ਰੂਰ ਹੁੰਦੀ ਆ ਥੋੜ੍ਹੀ ਜਿਹੀ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਜ਼ਿਆਦਾਤਰ ਮੱਛੀ ਜਾਂ ਤਾਂ ਆਪਾਂ ਨੂੰ ਸੂਈ ਖਾਣੀ ਚਾਹੀਦੀ ਹੈ ਜਾਂ ਖਾਣੀ ਚਾਹੀਦੀ ਹੈ ਮਲੀ